ਸਕੂਲਾਂ ਦੇ ਵਿੱਚ ਪਾਠਕ੍ਰਮ ਤੋਂ ਬਾਹਰ ਦੇ ਵਿੱਚ ਜੋ ਗਤੀਵਿਧੀਆਂ ਹੋਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਖੇਡਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਵਿੱਚ ਗਾਇਨ ਕਲਾ ਗਿੱਧਾ ਭੰਗੜਾ ਸਕਿੱਟ ਡਰਾਮੇ ਆਦਿ ਜਿਹੜੇ ਮੁਕਾਬਲੇ ਨੇ ਉਹ ਸਕੂਲਾਂ ਦੇ ਵਿੱਚ ਕਰਵਾਏ ਜਾਂਦੇ ਨੇ ਇਹਨਾਂ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀਆਂ ਖੇਡਾਂ ਵੀ ਸ਼ਾਮਿਲ ਹੁੰਦੀਆਂ ਨੇ ਜਿਹੜੇ ਇਹਨਾਂ ਵਿਦਿਆਰਥੀ ਇਹਨਾਂ ਮੁਕਾਬਲਿਆਂ ਦੇ ਵਿੱਚ ਵਿਦਿਆਰਥੀ ਜਿਹੜੇ ਹਿੱਸਾ ਲੈਂਦੇ ਨੇ ਉਹਨਾਂ ਵਿਦਿਆਰਥੀਆਂ ਵਿੱਚੋਂ ਜਿਹੜੇ ਪੁਜੀਸ਼ਨਾਂ ਹਾਸਲ ਕਰਦੇ ਨੇ ਪਹਿਲੀ ਪੁਜੀਸ਼ਨ ਦੂਜੀ ਪੁਜੀਸ਼ਨ ਜਾਂ ਤੀਜੀ ਪੁਜੀਸ਼ਨ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਨੇ ਉਹਨਾਂ ਨੂੰ ਐਪਰੀਸੀਏਸ਼ਨ ਵਜੋਂ ਸਰਟੀਫਿਕੇਟ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਇਨਾਮ ਵਜੋਂ ਟਰੋਫੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਪੈਸੇ ਦਿੱਤੇ ਜਾਂਦੇ ਨੇ ਪੈਸਿਆਂ ਤੋਂ ਇਲਾਵਾ ਉਹਨਾਂ ਨੂੰ ਅਜਿਹੀਆਂ ਵਸਤਾਂ ਜੋ ਉਹਨਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰ ਸਕਣ ਜਿਵੇਂ ਕੱਪੜੇ ਲੀੜੇ ਬੂਟ ਵਗੈਰਾ ਜਾਂ ਫਿਰ ਘਰ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਟੀ ਵੀ ਫਰਿੱਜ਼ ਆਦਿ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਇਨਾਮ ਵਜੋਂ ਅਤੇ ਅਸੀਂ ਵੀ ਆਪਣੇ ਸਕੂਲ ਦੇ ਵਿੱਚ ਜੋ ਗਤੀਵਿਧੀਆਂ ਹੁੰਦੀਆਂ ਨੇ ਮੁਕਾਬਲੇ ਉਹਨਾਂ ਵਿੱਚ ਖੇਡਾਂ ਵਿੱਚ ਹਿੱਸਾ ਲਿਆ ਫੁੱਟਬਾਲ ਦੀ ਟੀਮ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਨੇ ਜਿਵੇਂ ਛੇਵੀਂ ਜਮਾਤ ਦੀ ਟੀਮ ਸੱਤਵੀਂ ਦੀ ਅੱਠਵੀਂ ਦੀ ਇਸ ਤਰ੍ਹਾਂ ਅਸੀਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੇ ਨਾਲ਼ ਜੋ ਫੁੱਟਬਾਲ ਦੇ ਮੁਕਾਬਲੇ ਹੋਏ ਸੀ ਉਹਨਾਂ ਦੇ ਵਿੱਚ ਵੀ ਅਸੀਂ ਹਿੱਸਾ ਲਿਆ ਹੈ